ਹੈਲੋ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਪਹਿਚਾਣ ਲਿਆ ਜੀ ਹਾਂਜੀ ਪਹਿਚਾਣ ਲਿਆ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਤੁਹਾਡਾ ਕਿਹੜੀ ਇਲਾਕੇ ਚ ਤੁਸੀਂ ਕਰ ਲਿਆ ਹਾਂਜੀ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਤੇ ਇੱਥੇ ਨਾ ਤਿੰਨ ਚਾਰ ਹੈਗੇ ਨੇ ਸਿਨੇਮਾ ਹਾਲ ਜਿੱਥੇ ਤੁਸੀਂ ਜਾ ਸਕਦੇ ਜੀ ਜਿਹੜੇ ਰਾਮਪੁਰੇ ਤੇ ਤੁਹਾਨੂੰ ਕਰੀਬ ਚਾਰ ਪੰਜ ਕਿਲੋਮੀਟਰ ਦੇ ਅੰਦਰ ਅੰਦਰ ਮਿਲ ਜਾਣਗੇ ਇਕ ਤੇ ਹੈਗਾ ਜੀ ਐਮ ਆਰ ਏ ਐਨ ਕਲੇਮ ਉਦੇ ਚ ਨਾ ਦੋ ਸਕਰੀਨਸ ਹੈਗੀਆਂ ਨੇ ਤੇ ਉਹ ਤੁਸੀਂ ਇੱਕ ਮੋਸਟਲੀ ਪੰਜਾਬੀ ਮੂਵੀ ਚਲਦੀ ਵੀ ਹੁੰਦੀ ਹੈ ਤੇ ਕਦੇ ਕਦੇ ਹਿੰਦੀ ਮੂਵੀ ਵੀ ਮਿਲ ਜਾਂਦੀ ਉਹ ਸਾਨੂੰ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਨਲਾਈਨ ਟਿਕਟ ਵੀ ਬੁੱਕ ਹੋ ਸਕਦੀ ਨੇ ਤੇ ਇੱਕ ਦੂਸਰਾ ਸਿਨੇਮਾ ਹੈਗਾ ਇੱਥੇ ਔਰਬਿਟ ਸਿਨੇਮਾ ਹੈਗਾ ਉਹ ਤੁਹਾਨੂੰ ਓਨ ਦਾ ਰੋਡ ਹੀ ਮਿਲ ਜਾਏਗਾ ਜਦੋਂ ਤੁਸੀਂ ਰਾਮਪੁਰਾ ਤੋਂ ਸ਼ਹਿਰ ਵੱਲ ਆਓਗੇ ਤੇ ਹਾਂਜੀ ਹਾਂਜੀ ਉਹ ਬਿਲਕੁਲ ਓਨ ਦਾ ਰੋਡ ਤੁਹਾਨੂੰ ਮਿਲ ਜਾਏਗਾ ਤੇ ਉੱਥੇ ਵੀ ਹੈਗੀਆਂ ਸਕਰੀਨ ਅੱਛਾ ਸਾਰੀ ਫੈਸਲਿਟੀ ਵੀ ਅੱਛੀ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਜੇ ਆਨਲਾਈਨ ਵੀ ਚੈੱਕ ਹੋ ਜੇਗਾ ਹਾਂਜੀ ਮੇਨ ਤਾਂ ਦੋ ਹੀ ਨੇ ਬਾਕੀ ਜੇ ਤੁਸੀਂ ਇਧਰ ਥੋੜਾ ਜਿਹਾ ਆਬੋਹਰ ਵੱਲ ਜਾਣਾ ਚਾਹੋਗੇ ਤੇ ਉਧਰ ਵੀ ਤੁਹਾਨੂੰ ਦੋ ਤਿੰਨ ਸਿਨੇਮਾ ਮਿਲ ਜਾਣਗੇ ਹੋਰ ਮਿਹਰਬਾਨੀ ਹਾਂਜੀ ਹਾਂਜੀ ਹਾਂਜੀ ਹਾਂਜੀ ਐਮ ਆਰ ਜਿਹੜਾ ਹੈਗਾ ਐਮ ਐਰ ਜਿਹੜਾ ਹੈਗਾ ਉਹ ਕਾਫੀ ਅੱਛਾ ਹੈ ਅਸੀਂ ਦੋ ਚਾਰ ਵਾਰੀ ਉਹਦੇ ਦੇਖ ਕੇ ਆਏ ਆਂ ਤੇ ਐਮ ਐਰ ਆ ਠੀਕ ਹੈ ਜੀ

ਓਕੇ ਥੈਂਕਯੂ